ਭੰਗੜਾ ਸਾਡੇ ਪੰਜਾਬ ਦਾ ਲੋਕ ਨਾਚ ਹੈ ਇਸ ਵਿੱਚ ਪੰਜਾਬੀ ਗੱਭਰੂ ਕੁੜਤਾ ਚਾਦਰਾ ਗਲ ਵਿੱਚ ਕੈਂਠਾ ਸਿਰ 'ਤੇ ਛਮਲਾ ਅਤੇ ਪੈਰਾਂ ਵਿੱਚ ਤਿੱਲੇਦਾਰ ਜੁੱਤੀ ਪਾ ਕੇ ਬਹੁਤ ਸੋਹਣੇ ਲੱਗਦੇ ਹਨ ਅਤੇ ਇਹ ਭੰਗੜਾ ਪਾ ਕੇ ਦਰਸ਼ਕਾਂ ਨੂੰ ਆਪਣੀ ਤਰਫ ਆਕਰਸ਼ਿਤ ਕਰਦੇ ਹਨ ਇਹ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਗੱਲ ਕਰਦੇ ਹਨ ਅਤੇ ਭੰਗੜੇ ਵਿੱਚ ਆਪਣੇ ਚੰਗੇ ਪ੍ਰਦਰਸ਼ਨ ਨਾਲ ਲੋਕਾਂ ਦਾ ਦਿਲ ਜਿੱਤਦੇ ਹਨ ਇਹ ਸਾਡੇ ਪੰਜਾਬੀ ਵਿਰਸੇ ਦਾ ਬਹੁਤ ਵੱਡਾ ਅੰਗ ਹਨ